ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਪੂਨਮ ਬੂਟ ਹਾਊਸ ਬਰਨਾਲਾ ਤੋਂ ਬੋਲ ਰਹੇ ਜੀ ਅਸੀਂ ਦੇਖੋ ਜੀ ਸਪੋਰਟਸ ਚਾਹੀਦੇ ਆ ਫਾਰਮਲ ਚਾਹੀਦੇ ਕਿਹੜੇ ਚਾਹੀਦੇ ਆ ਤੁਹਾਨੂੰ ਫਾਰਮਲ ਚਾਹੀਦੇ ਆ ਠੀਕ ਹੈ ਅੱਛਾ ਅੱਛਾ ਕਿਹੜਾ ਕਲਰ ਚਾਹੀਦਾ ਦੇਖੋ ਜੀ ਸਾਰਾ ਕੁਛ ਅਵੇਲੇਬਲ ਹੈਗਾ ਡਿਜ਼ਾਇਨ ਵੀ ਬਹੁਤ ਅੱਛੇ ਅੱਛੇ ਆਏ ਫਲੈਟ ਵੀ ਨੇ ਹੀਲਸ ਨਾਲ ਵੀ ਨੇ ਤੁਸੀਂ ਜਿਸ ਦਿਨ ਮਰਜ਼ੀ ਆਪਣੀ ਸ਼ੋਪ 'ਤੇ ਆਓ ਪਸੰਦ ਕਰਕੇ ਆਪਣੀ ਮਰਜ਼ੀ ਦੇ ਲੈ ਕੇ ਜਾਓ ਦੇਖੋ ਜੀ ਸਾਰਾ ਕੁਛ ਹੀ ਮਿਲ ਜਾਂਦਾ ਬੱਚਿਆਂ ਦੇ ਵੀ ਮਿਲ ਜਾਂਦੇ ਲੇਡੀਜ ਦੇ ਵੀ ਮਿਲ ਜਾਂਦੇ ਆ ਜੈਂਟਸ ਦੇ ਸਪੋਰਟਸ ਵੀ ਮਿਲ ਜਾਂਦੇ ਆ ਫੋਰਮਲ ਵੀ ਮਿਲ ਜਾਂਦੇ ਆ ਲੇਡੀਜ ਦੀਆਂ ਹੀਲਜ਼ ਵੀ ਮਿਲ ਜਾਂਦੀਆਂ ਸਾਰਾ ਕੁਛ ਅਵੇਲੇਬਲ ਹੈਗਾ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਸਾਡੇ ਕੋਲ ਸਾਰੀ ਰੇਂਜ ਦੇ ਹੈਗੇ ਦੇਖੋ ਜੀ ਪੰਜ ਸੌ ਤੋਂ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਤੱਕ ਮਰਜ਼ੀ ਤੁਸੀਂ ਲੈ ਲਉ ਉਹ ਤਾਂ ਆਪਣੀ ਇੱਛਾ ਹਾਂਜੀ ਹਾਂਜੀ ਲੈਦਰ ਪੂਰਾ ਵਧੀਆ ਵਾ ਕੁਆਲਿਟੀ ਪੂਰੀ ਵਧੀਆ ਵਾ ਇਹੋ ਜਿਹੀ ਕੋਈ ਗੱਲ ਨਹੀਂ ਹੈਂ ਹਾਂ ਹਾਂਜੀ ਹਾਂਜੀ ਹਾਂਜੀ ਸਾਰੇ ਸਾਰੇ ਸਾਈਜ਼ ਮਿਲ ਜਾਣਗੇ ਤੁਹਾਡਾ ਕਿੰਨਾ ਸਾਈਜ਼ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਸਾਰਾ ਕੁਛ ਮਿਲ ਜੂਗਾ ਤੁਸੀਂ ਕੱਲ ਨੂੰ ਜਾਂ ਜਿੱਦਣ ਮਰਜ਼ੀ ਅ ਆ ਜਿਓ ਸ਼ੌਪ 'ਤੇ ਹਾਂਜੀ ਹਾਂਜੀ ਸਾਰਾ ਕੁਛ ਸਾਰਾ ਹਾਂਜੀ ਹਾਂਜੀ

ਠੀਕ ਹੈ ਜੀ ਠੀਕ ਹੈ ਜਦੋਂ ਮਰਜ਼ੀ ਆਇਓ ਇਹ ਸਦਰ ਬਜ਼ਾਰ 'ਚ ਆ ਉਹ ਦਾਦੂ ਬੇਕਰੀ ਤੋਂ ਥੋੜ੍ਹਾ ਅੱਗੇ ਆ ਕੇ ਅਤੇ ਉੱਥੇ ਆ ਹਾਂਜੀ ਹਾਂਜੀ ਨਹੀਂ ਨਹੀਂ ਤੁਸੀਂ ਦਾਦੂ ਸ਼ੋਪ ਤੋਂ ਆ ਕੇ ਰਾਈਟ ਸਾਈਡ ਮੁੜਨਾ ਹਾਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ